ਬਹੁਤ ਸਾਰੇ ਐਪਸ ਹਨ ਜਿਹੜੇ ਕਿ ਮੇਰੀ ਰੋਜ਼ਾਨਾ ਮਦਦ ਕਰਦੇ ਹਨ ਜਿਵੇਂ ਕਿ ਕੈਮਰਾ ਜਿਹੜਾ ਕਿ ਮੇਰੀਆਂ ਫੋਟੋਜ਼ ਕਲਿੱਕ ਕਰਨ ਵਿੱਚ ਮੇਰੀ ਮਦਦ ਕਰਦਾ ਹੈ ਅਤੇ ਗੈਲਰੀ ਵਿੱਚ ਉਹਨਾਂ ਨੂੰ ਸਟੋਰ ਕਰਦਾ ਹੈ ਫੋਟੋਜ਼ ਗੈਲਰੀ ਜਿਸ ਵਿੱਚ ਮੇਰੀਆਂ ਬਹੁਤ ਸਾਰੀਆਂ ਫੋਟੋਜ਼ ਪੁਰਾਣੀਆਂ ਫੋਟੋਜ਼ ਪਈਆਂ ਹੁੰਦੀਆਂ ਹਨ ਜਿਸ ਨੂੰ ਮੈਂ ਕਿਸੇ ਵੀ ਟਾਈਮ ਦੇਖ ਸਕਦੀ ਹਾਂ ਵਟਸਐਪ ਜਿਸ ਵਿੱਚ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਫੈਮਿਲੀਜ਼ ਨੂੰ ਵੋਇਸ ਕਾਲ ਵੀਡੀਓ ਕਾਲ ਜਾਂ ਮੈਸੇਜਸ 'ਤੇ ਗੱਲ ਕਰ ਸਕਦੀ ਹਾਂ ਇਸ ਤੋਂ ਇਲਾਵਾ ਸ਼ੋਪਿੰਗ ਐਪਸ ਜਿਵੇਂ ਕਿ ਮਿਸ਼ੂ ਐਮੇਜ਼ੋਨ ਫਲਿਪਕਾਰਟ ਜਿਸ ਨਾਲ ਮੈਂ ਘਰ ਬੈਠੇ ਹੀ ਸ਼ੋਪਿੰਗ ਕਰਦੀ ਹਾਂ ਇਸ ਤੋਂ ਇਲਾਵਾ ਆਨਲਾਈਨ ਪੇਇੰਗ ਐਪਸ ਜਿਸ ਵਿੱਚ ਪੇਟੀਐਮ ਗੂਗਲ ਪੇ ਜਿਸ ਨਾਲ ਮੈਂ ਘਰ ਬੈਠੇ ਹੀ ਪੈਸੇ ਸੈਂਡ ਕਰ ਸਕਦੀ ਹਾਂ ਅਤੇ ਮੰਗਵਾ ਸਕਦੀ ਹਾਂ ਇਸ ਤੋਂ ਇਲਾਵਾ ਯੂਟੀਊਬ ਜਿਸ ਵਿੱਚ ਮੈਂ ਆਪਣੀ ਸਟਡੀ ਦੇ ਰਿਲੇਟਡ ਜਾਂ ਫਿਰ ਕੁਕਿੰਗ ਦੇ ਰਿਲੇਟਡ ਵੀਡੀਓਜ ਦੇਖਦੀ ਹਾਂ ਇਸ ਤੋਂ ਇਲਾਵਾ ਗੂਗਲ ਜਿਸ ਵਿੱਚ ਮੈਂ ਕਿਸੇ ਵੀ ਟੋਪਿਕ ਦੇ ਰਿਲੇਟਡ ਸਰਚ ਕਰਕੇ ਇਨਫੋਰਮੇਸ਼ਨ ਕਲੈਕਟ ਕਰਦੀ ਹਾਂ ਸਫੋਟੀਫਾਈ ਜਿਸ ਵਿੱਚ ਮੈਂ ਆਪਣੇ ਮਨੋਰੰਜਨ ਲਈ ਗਾਣੇ ਸੁਣਦੀ ਹਾਂ